ਜਦੋਂ ਅਸੀਂ ਬਾਗ਼ਬਾਨੀ ਕਰਦੇ ਹਾਂ ਜਾਂ ਖੇਤ ਦੇ ਵਿੱਚ ਖੇਤੀ ਕਰਦੇ ਹਾਂ ਤਾਂ ਕਈ ਵਾਰ ਸਾਨੂੰ ਕੀੜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿੱਚ ਜਿਵੇਂ ਸਿਉਂਕ ਲੱਗ ਜਾਂਦੀ ਹੈ ਉਹ ਸਿਉਂਕ ਨੂੰ ਅਸੀਂ ਸਿਉਂਕ ਦੇ ਵਿੱਚ ਅਸੀਂ ਡੀ ਡੀ ਟੀ ਜਾਂ ਹੋਰ ਕੋਈ ਕੀਟਨਾਸ਼ਕ ਜਿਹੜੀਆਂ ਪਾਣੀ ਕੀਟਨਾਸ਼ਕ ਦਵਾਈਆਂ ਪਾ ਕੇ ਅਸੀਂ ਉਸ ਨੂੰ ਉਸ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਹੋਰ ਤਰ੍ਹਾਂ ਦੀਆਂ ਵੀ ਕਈ ਕੀਟਨਾਸ਼ਕ ਆਉਂਦੀਆਂ ਹਨ ਜੋ ਅਸੀਂ ਪਾਣੀ ਵਿੱਚ ਘੋਲ ਕੇ ਅਤੇ ਪੌਦਿਆਂ ਦੇ ਉੱਤੇ ਛੜਕਾਅ ਕਰਦੇ ਹਾਂ ਤਾਂ ਜੋ ਸਾਡੀ ਫ਼ਸਲ ਜਿਹੜੀ ਹੈਗੀ ਹੈ ਉਹ ਵਧੀਆ ਤਰੀਕੇ ਨਾਲ਼ ਹੋ ਸਕੇ